ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕੌਣ ਹਾਂਜੀ ਹਾਂਜੀ ਓਕੇ ਹਾਂਜੀ ਓਕੇ ਹਾਂਜੀ ਹਾਂਜੀ ਉਸ ਸਾਈਡ ਮੇਰੇ ਬਹੁਤ ਜ਼ਿਆਦਾ ਲਿੰਕ ਹੈਗੇ ਹੈ ਅਤੇ ਕੋਈ ਨਹੀਂ ਮੈਂ ਉੱਥੇ ਤੁਸੀਂ ਮੇਰੇ ਕੋਲ ਆ ਜਿਓ ਦੋ ਤਿੰਨ ਦਿਨ ਮੇਰੇ ਕੋਲ ਰਿਹੋ ਆਪਾਂ ਕੋਈ ਵੀ ਪੀ ਜੀ ਜਾ ਕੇ ਲੱਭ ਲਵਾਂਗੇ ਜਿਹੜਾ ਤੁਹਾਨੂੰ ਵਧੀਆ ਲੱਗੇਗਾ ਆਪਾਂ ਉਹ ਸਲੈਕਟ ਕਰ ਲਵਾਂਗੇ ਫਿਰ ਅੱਛਾ ਤੁਸੀਂ ਗਰਲਜ਼ ਕੋਲੇਜ ਫੋਟੀ ਟੂ ਵਿੱਚ ਪੜ੍ਹਦੇ ਹੋ ਓਕੇ ਕੋਈ ਗੱਲ ਨਹੀਂ ਮੈਂ ਉਹਦੇ ਨੇੜੇ ਮੇਰੇ ਬਹੁਤ ਜ਼ਿਆਦਾ ਹੈਗੇ ਹੈ ਨੋਨ ਮੈਂ ਉਥੇ ਤੁਹਾਨੂੰ ਦਵਾ ਦੇਵਾਂਗੀ ਹਾਂਜੀ ਹਾਂਜੀ ਕੋਈ ਨਹੀਂ ਆ ਸਕਦੇ ਹੈ ਉਹ ਹਾਂ ਨਹੀਂ ਉਥੇ ਪੀ ਜੀ ਵਿੱਚ ਕੁੱਕ ਰੱਖਿਆ ਹੋਇਆ ਹੈ ਉਹ ਵਧੀਆ ਖਾਣਾ ਤੁਹਾਨੂੰ ਸਵੇਰ ਦਾ ਦੁਪਹਿਰ ਦਾ ਰਾਤ ਦਾ ਦੇਵੇਗਾ ਅਤੇ ਜੋ ਰੈਂਟ ਹੈ ਉਹ ਪੰਜ ਤੋਂ ਛੇ ਹਜ਼ਾਰ ਤੱਕ ਮੇਰੇ ਹਿਸਾਬ ਨਾਲ ਹੈਗਾ ਉੱਥੇ ਹਾਂਜੀ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਆ ਜਿਓ ਤੁਸੀਂ ਦੋ ਤਿੰਨ ਦਿਨ ਮੇਰੇ ਕੋਲ ਰਿਹੋ ਫੇਰ ਆਪਾਂ ਦੇਖ ਲਵਾਂਗੇ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਆ ਜਿਓ ਓਕੇ